ਸਾਡੇ ਖੇਤਰ ਵਿੱਚ ਮੁੱਖ ਤੌਰ 'ਤੇ ਉੱਭਰਨ ਵਾਲੀਆਂ ਕਲਾਵਾਂ ਇਹ ਹਨ ਜਿਵੇਂ ਟੋਕਰੀ ਬਣਾਉਣਾ ਫੁਲਕਾਰੀ ਕੱਢਣਾ ਔਰਤਾਂ ਦੁਆਰਾ ਚਰਖਾ ਕੱਤਣਾ ਅਤੇ ਕਈ ਔਰਤਾਂ ਸਿਲਾਈ ਨਾਲ ਪੁਰਾਣੀ ਪੱਛਮ ਨੂੰ ਰੰਗ ਕੇ ਉਸ ਦੀਆਂ ਨਵੀਆਂ ਸਵੈਟਰਾਂ ਤਿਆਰ ਕਰਦੀਆਂ ਹਨ ਉਨ੍ਹਾਂ ਦੀਆਂ ਇਹ ਵਿਸ਼ੇਸ਼ਤਾ ਹਨ ਕਿ ਟੋਕਰੀਆਂ ਵਿੱਚ ਅਸੀਂ ਘਰ ਵਿੱਚ ਜੋ ਵੀ ਫਾਲਤੂ ਸਮਾਨ ਹੈ ਉਸ ਨੂੰ ਜਮ੍ਹਾਂ ਕਰਕੇ ਰੱਖ ਸਕਦੇ ਹਾਂ ਇਸ ਦਾ ਇੱਕ ਹੋਰ ਵੀ ਫਾਇਦਾ ਹੈ ਕਿ ਜੋ ਅਸੀਂ ਪਾਲਤੂ ਜਾਨਵਰ ਘਰ ਵਿੱਚ ਰੱਖੇ ਹੁੰਦੇ ਹਨ ਉਹਨਾਂ ਨੂੰ ਚਾਰਾ ਵੀ ਇਹਨਾਂ ਟੋਕਰੀਆਂ ਨਾਲ ਪਾ ਸਕਦੇ ਹਾਂ ਇਸ ਦੇ ਨਾਲ ਨਾਲ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਟੋਕਰੀਆਂ ਸਿਖਾਉਣ ਲਈ ਇਹ ਰੁਜ਼ਗਾਰ ਦਾ ਸਾਧਨ ਵੀ ਹੈ ਫੁਲਕਾਰੀ ਦੀ ਵਿਸ਼ੇਸ਼ਤਾ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਮਹੱਤਵ ਰੱਖਦੀ ਹੈ ਇਸ ਦੀ ਵਿਆਹ ਸ਼ਾਦੀਆਂ ਵਿੱਚ ਰਸਮੀ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ ਫੁਲਕਾਰੀ ਕੱਢਣ ਵਾਲੀਆਂ ਔਰਤਾਂ ਨੂੰ ਇਸਦੀ ਚੰਗੀ ਕੀਮਤ ਮਿਲ ਜਾਂਦੀ ਹੈ ਅਤੇ ਨਾਲ ਨਾਲ ਮਨੋਰੰਜਨ ਵੀ ਹੋ ਜਾਂਦਾ ਹੈ ਜੋ ਵੀ ਔਰਤਾਂ ਘਰਾਂ ਵਿੱਚ ਸਵੈਟਰਾਂ ਤਿਆਰ ਕਰਦੀਆਂ ਹਨ ਇੱਕ ਤਾਂ ਉਹ ਕੀਮਤ ਜਾਇਜ਼ ਲੈਂਦੀਆਂ ਹਨ ਦੂਜਾ ਇਹ ਹੰਢਨਸਾਰ ਹੁੰਦੀਆਂ ਹਨ ਫੁਲਕਾਰੀਆਂ ਅਤੇ ਸਵੈਟਰਾਂ ਨੂੰ ਦੇਖ ਕੇ ਸਵਦੇਸ਼ੀ ਵੀ ਲੋਚਦੇ ਹਨ ਕਿ ਪਿੰਡਾਂ ਵਿੱਚੋਂ ਫੁਲਕਾਰੀ ਜਾਂ ਸਵੈਟਰ ਤਿਆਰ ਕਰਵਾਈ ਜਾਵੇ